ਹੈਲੋ ਹਾਂਜੀ ਹਾਂਜੀ ਦੱਸੋ ਹਾਂਜੀ ਹਾਂਜੀ ਦੱਸੋ ਹਾਂਜੀ ਠੀਕ ਹੈ ਅੱਛਾ ਅੰਮ੍ਰਿਤਸਰ ਤੋਂ ਦਿੱਲੀ ਹਾਂ ਇੱਕ ਸਵੇਰੇ ਜਾਂਦੀ ਛੇ ਵਜੇ ਹਾਂਜੀ ਦੂਜੀ ਚੱਲਦੀ ਚਾਰ ਵਜੇ ਸ਼ਾਮ ਨੂੰ ਚਾਰ ਵਜੇ ਹਾਂ ਇੱਕ ਹੁਣ ਨਵੀਂ ਚੱਲੀ ਹੈ ਬੰਦੇ ਭਾਰਤ ਸੁਪਰ ਫਾਸਟ ਹੀ ਹੈ ਅੱਛਾ ਦਸ ਤਾਰੀਖ ਦੀਆਂ ਕਿਹੜੇ ਵਾਲੀ ਟ੍ਰੇਨ ਦੀਆਂ ਇੱਕ ਰਾਤ ਦੀ ਵੀ ਹੈਗੀ ਹੈ ਦਸ ਪੰਜਾਹ 'ਤੇ ਚੱਲੇਗੀ ਹਾਂਜੀ ਹਾਂਜੀ ਅੱਛਾ ਦੋ ਤੁਹਾਨੂੰ ਅਡਲਟ ਚਾਹੀਦੀਆਂ ਨੇ ਹਾਂਜੀ ਹਾਂਜੀ ਅੰਦਰ ਬੈਡਿੰਗ ਵੀ ਹੁੰਦਾ ਮਿਲ ਜਾਂਦਾ ਤੁਹਾਨੂੰ ਮਿਲੇਗਾ ਹਾਂਜੀ ਅੰਦਰ ਖਾਣਾ ਬਾਣਾ ਵੀ ਮਿਲ ਜਾਂਦਾ ਚਾਹ ਵਗੈਰਾ ਵੀ ਮਿਲ ਜਾਂਦੀ ਹੈ ਹਾਂਜੀ ਹਾਂਜੀ ਸਭ ਕੁਛ ਮਿਲੇਗਾ ਹਾਂਜੀ ਆਰਡਰ 'ਤੇ ਅਤੇ ਸਾਨੂੰ ਦੋ ਅਡਲਟ ਚਾਹੀਦੀਆਂ ਨੇ ਅਤੇ ਦੋ ਹੋਰ ਹਾਂਜੀ ਅੱਛਾ ਦਸ ਤਾਰੀਖ ਦੀਆਂ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਹੋਲਡ ਰੱਖਣਾ ਮੈਂ ਦੇਖ ਕੇ ਦੱਸਦੀ ਰਾਤ ਨੂੰ ਜੇ ਜਿਹੜੀ ਦਸ ਪੰਜਾਹ 'ਤੇ ਚੱਲਦੀ ਹੈ ਉਹਦੇ ਵਿੱਚ ਤੁਹਾਨੂੰ ਮਿਲ ਜਾਣਗੀਆਂ ਸੀਟਾਂ ਉਹ ਹੀ ਬੰਦੇ ਭਾਰਤ ਜਿਹੜੀ ਚਾਰ ਵਜੇ ਚੱਲਦੀ ਹੈ ਉਨਦੇ 'ਚ ਤੁਹਾਨੂੰ ਫਿਰ ਸਿਟਿੰਗ ਮਿਲੇਗੀ ਜਾਂ ਵੇਟਿੰਗ ਵਿੱਚ ਹੈ ਹਾਂਜੀ ਖਾਣਾ ਬਹੁਤ ਅੱਛਾ ਹੁੰਦਾ ਬੈਡ ਵਗੈਰਾ ਵੀ ਮਿਲਦੇ ਆ ਬਲੈਂਕਟ ਹਾਂਜੀ ਹਾਂਜੀ ਹਾਂਜੀ ਹਾਂਜੀ ਪੂ ਪੂਰਾ ਅਰੇਂਜਮੈਂਟ ਹੁੰਦਾ ਉੱਥੇ ਪੂਰਾ ਅਰੇਂਜਮੈਂਟ ਠੀਕ ਹੈ ਫਿਰ ਉਹ ਦਸ ਪੰਜਾਹ ਵਾਲੀ ਟਰੇਨ ਜੋ ਬੰਦੇ ਭਾਰਤ ਉਹਦੀ ਕਰਵਾਉਣੀ ਹੈ ਫਿਰ ਤੁਸੀਂ ਠੀਕ ਹੈ ਜੀ ਠੀਕ ਹੈ ਬਿਲਕੁਲ